ਪੰਜਾਬ ਦੇ ਕਹਿ ਲਓ ਕਿ ਬਹੁਤ ਸਾਰੇ ਮਹੱਤਵਪੂਰਨ ਤਿਉਹਾਰ ਨੇ ਜਿਨ੍ਹਾਂ ਤਿਉਹਾਰਾਂ 'ਤੇ ਸਾਨੂੰ ਬੜਾ ਚਾਅ ਹੁੰਦਾ ਹੈ ਕਿ ਇਨ੍ਹਾਂ ਤਿਉਹਾਰਾਂ 'ਤੇ ਛੁੱਟੀਆਂ ਵੀ ਆਉਣਗੀਆਂ ਜਿਸ ਤਰ੍ਹਾਂ ਪੰਜ ਭਾਰਤ ਦਾ ਸਭ ਤੋਂ ਮਸ਼ਹੂਰ ਜਿਹੜਾ ਤਿਉਹਾਰ ਹੈਗੇ ਆ ਜਿਸ ਤਰ੍ਹਾਂ ਕਹਿ ਲਓ ਦਿਵਾਲੀ ਹੋਲੀ ਮਕਰ ਸੰਕ੍ਰਾਂਤੀ ਇਹ ਤਾਂ ਪੂਰੇ ਭਾਰਤ ਵਿੱਚ ਮਨਾਏ ਜਾਂਦੇ ਨੇ ਦਿਵਾਲੀ ਤਾਂ ਕਹਿ ਲਓ ਕਿ ਬੜਾ ਵੱਡਾ ਤਿਉਹਾਰ ਹੈ ਭਾਰਤ ਦਾ ਇਹਨਾਂ ਦੇ ਵਿੱਚ ਕਹਿ ਲਓ ਕਿ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਨਵੇਂ ਨਵੇਂ ਕੱਪੜੇ ਪਾ ਕੇ ਲੋਕ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਦੇ ਘਰ ਜਾਂਦੇ ਨੇ ਇੱਕ ਦੂਜੇ ਨੂੰ ਤੋਹਫ਼ੇ ਦਿੰਦੇ ਨੇ ਮਿਠਾਈਆਂ ਵੰਡਦੇ ਨੇ ਇੱਕ ਕਹਿ ਲਓ ਕਿ ਦਿਵਾਲੀ ਦੇ ਦਿਨਾਂ ਵਿੱਚ ਇੱਕ ਵੱਖਰਾ ਹੀ ਮਾਹੌਲ ਹੁੰਦਾ ਲੋਕ ਕਿਆ ਆਪਣੇ ਘਰਾਂ ਦੀਆਂ ਸਾਫ਼ ਸਫ਼ਾਈਆਂ ਕਰਦੇ ਨੇ ਹੋਲੀ ਆਉਂਦੀ ਹੈ ਸਾਰੇ ਮਿਲ ਕੇ ਮਿੱਠੇ ਬਣਾਉਂਦੇ ਨੇ ਇੱਕ ਦੂਜੇ ਨੂੰ ਰੰਗ ਬਿਰੰਗੇ ਰੰਗ ਲਾਉਂਦੇ ਨੇ ਕੋਈ ਸੁੱਕੇ ਰੰਗ ਖੇਲ ਰਿਹਾ ਕੋਈ ਮਿਠਾਈਆਂ ਖਾ ਰਿਹਾ ਕੋਈ ਰਲ ਕੇ ਤਿਉਹਾਰ ਮਨਾ ਰਿਹਾ ਉਸ ਤੋਂ ਬਾਅਦ ਇੱਕ ਹੁਣ ਪਿੱਛੇ ਹੀ ਨਿਕਲ ਕੇ ਗਿਆ ਹੈ ਮਕਰ ਸੰਕ੍ਰਾਂਤੀ ਦਾ ਤਿਉਹਾਰ ਕਹਿ ਲਓ ਕਿ ਭਾਰਤ ਵਿੱਚ ਮਨਾਇਆ ਤਾਂ ਹਰ ਰਾਜ ਵਿੱਚ ਜਾਂਦਾ ਲੇਕਿਨ ਇਹਦੀ ਮਹੱਤਵਤਾ ਵੀ ਬੜੀ ਹੈ ਇਸ ਦਿਨ ਪੂਰੇ ਹਿੰਦੁਸਤਾਨ ਵਿੱਚ ਇੱਕ ਵੱਖਰਾ ਹੀ ਮਾਹੌਲ ਹੁੰਦਾ ਹਰ ਘਰ ਦੇ ਵਿੱਚ ਗੁੜ ਦੀਆਂ ਬਣੀਆਂ ਚੀਜ਼ਾਂ ਬਣਦੀਆਂ ਨੇ ਖਿਚੜੀ ਬਣਾਉਂਦੇ ਨੇ ਲੋਕ ਪਤੰਗ ਉਡਾਉਂਦੇ ਨੇ ਹਰ ਤਿਉਹਾਰ ਦਾ ਇੱਕ ਆਪਣਾ ਹੀ ਮਜ਼ਾ ਹੈ ਭਾਰਤ ਦੇ ਵਿੱਚ ਤਾਂ ਇਹਨਾਂ ਨੂੰ ਛੱਡ ਕੇ ਹੋਰ ਵੀ ਕਈ ਤਰ੍ਹਾਂ ਦੇ ਤਿਉਹਾਰ ਨੇ ਜਿਸ ਤਰ੍ਹਾਂ ਕਹਿ ਲਓ ਕਿ ਕਲਕੱਤੇ ਵਿੱਚ ਦੁਰਗਾ ਪੂਜਾ ਬੜੀ ਮਸ਼ਹੂਰ ਹੈ ਉਸ ਦਿਨ ਨੌ ਦਸ ਦਿਨ ਸਕੂਲ ਸਭ ਜਗ੍ਹਾ ਉੱਥੇ ਛੁੱਟੀਆਂ ਹੁੰਦੀਆਂ ਨੇ ਲੋਕ ਬੜੇ ਉਤਸ਼ਾਹ ਨਾਲ ਦੁਰਗਾ ਪੂਜਾ ਮਨਾਉਂਦੇ ਨੇ ਨਵਰਾਤਰਿਆਂ 'ਚ ਹੁੰਦੀ ਹੈ ਲੋਕ ਪੂਰੀ ਮਾਂ ਕਾਲੀ ਦੀ ਅਰਾਧਨਾ ਕਰਦੇ ਨੇ ਹਰ ਤਿਉਹਾਰ ਦਾ ਕਹਿ ਲਓ ਕਿ ਭਾਰਤ ਦੇ ਵਿੱਚ ਕੁਛ ਆਪਣਾ ਹੀ ਮਜ਼ਾ